ਮੋਹਾਲੀ ਜ਼ਿਲ੍ਹੇ ਦਾ ਜਿਹੜਾ ਮੌਸਮ ਹੈ ਉਹ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਕਿਉਂਕਿ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਉਸਦੇ ਨਾਲ ਜਿਹੜੇ ਉੱਥੇ ਮੋਹਾਲੀ ਹੈ ਉੱਥੇ ਬਹੁਤ ਜ਼ਿਆਦਾ ਵਹੀਕਲਸ ਦੇ ਹੋਣ ਕਰਕੇ ਬਹੁਤ ਜ਼ਿਆਦਾ ਪ੍ਰਦੂਸ਼ਣ ਹੋ ਜਾਂਦਾ ਹੈ ਜਿਸ ਦੇ ਨਾਲ ਕਿ ਤਾਪਮਾਨ ਹੋਰ ਵੀ ਜ਼ਿਆਦਾ ਗਰਮ ਹੋ ਜਾਂਦਾ ਹੈ ਅਤੇ ਇੱਧਰ ਜਦੋਂ ਸਰਦੀਆਂ ਆਉਂਦੀਆਂ ਹਨ ਉਦੋਂ ਠੰਡ ਵੀ ਬਹੁਤ ਪੈਂਦੀ ਹੈ ਕਿਉਂਕਿ ਇੱਥੇ ਇੰਨੀ ਜ਼ਿਆਦਾ ਧੁੱਪ ਸਰਦੀਆਂ ਦੇ ਟਾਈਮ ਦੇ ਵਿੱਚ ਨਹੀਂ ਨਿਕਲਦੀ ਹੈ ਅਤੇ ਤਾਪਮਾਨ ਨਾ ਤਾਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਕਠੋਰ ਹੈ ਨਾ ਹੀ ਜ਼ਿਆਦਾ ਠੰਡਾ ਹੁੰਦਾ ਉਸ ਟਾਈਮ ਦੇ ਵਿੱਚ ਠੀਕ ਠੀਕ ਹੁੰਦਾ ਹੈ